ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਾਨਵ ਪਠਾਨੀਆ ਹੈ ਮੈਂ ਪੰਜਾਬ ਦਾ ਰਹਿਣ ਵਾਲਾ ਹਾਂ ਜਿੱਦਾਂ ਕਿ ਇਹ ਸਵਾਲ ਮੈਨੂੰ ਪੁੱਛਿਆ ਗਿਆ ਹੈ ਕਿ ਤੁਸੀਂ ਕਦੇ ਕਿਸੇ ਪੂਰੀ ਤਰ੍ਹਾਂ ਵੱਖਰੀ ਭਾਸ਼ਾ ਅਤੇ ਸੱਭਿਆਚਾਰ ਵਾਲੀ ਜਗ੍ਹਾ ਦੀ ਯਾਤਰਾ ਕੀਤੀ ਹੈ ਅਗਰ ਮੈਂ ਇਸ ਦਾ ਜਵਾਬ ਦੇਵਾਂ ਤਾਂ ਮੇਰਾ ਜਵਾਬ ਇਹ ਹੈ ਕਿ ਹਾਂ ਉਹ ਕੁਝ ਇਸ ਪ੍ਰਕਾਰ ਹੈ ਕਿ ਆਪਾਂ ਪੂਰਾ ਪਰਿਵਾਰ ਜਿੰਨਾਂ ਨੂੰ ਮੰਨਦੇ ਹਨ ਜੋ ਕਿ ਸਾਡੇ ਕੁਲ ਦੇਵਤੇ ਹਨ ਉਹਨਾਂ ਦੀ ਜਗ੍ਹਾ ਰਾਜਸਥਾਨ ਵਿਖੇ ਹੈ ਆਪਾਂ ਕੁਝ ਸਪਤਾਹ ਪਹਿਲਾਂ ਹੀ ਰਾਜਸਥਾਨ ਗਏ ਸੀ ਜਿੱਥੇ ਉਹਨਾਂ ਦੀ ਬੋਲੀ ਉਨ੍ਹਾਂ ਦਾ ਰਹਿਣਾ ਸਹਿਣਾ ਉਹਨਾਂ ਦਾ ਖਾਣਾ ਪੀਣਾ ਸਭ ਕੁਝ ਉਹਨਾਂ ਦਾ ਵੱਖ ਤਰੀਕੇ ਦਾ ਹੈ ਆਪਾਂ ਹਨੂੰਮਾਨਗੜ੍ਹ ਤੋਂ ਅੱਗੇ ਗਏ ਸੀ ਅੱਗੇ ਜਾ ਕੇ ਪਹਿਲਾਂ ਆਪਾਂ ਗੋਰਖ ਟਿੱਲੇ ਜਿੱਥੇ ਕਿ ਉੱਥੇ ਆਪਾਂ ਸਾਰੇ ਪਹਿਲਾਂ ਦਰਸ਼ਨ ਕੀਤੇ ਫਿਰ ਆਪਾਂ ਜੋ ਕਿ ਸਾਡੇ ਕੁਲ ਦੇਵਤਾ ਸ੍ਰੀ ਗੋਗਾ ਮਹਾਰਾਜ ਜੀ ਸਨ ਉਹਨਾਂ ਦੀ ਜਗ੍ਹਾ ਗੋਗਾ ਮਾੜੀ ਗਏ ਉੱਥੇ ਆਪਾਂ ਕਾਫ਼ੀ ਦਿਨ ਰਹੇ ਦਰਸ਼ਨ ਕੀਤੇ ਅਤੇ ਉੱਥੇ ਕਾਫ਼ੀ ਬੰਦਿਆਂ ਦੀ ਬੋਲੀ ਸੁਣ ਕੇ ਆਪਾਂ ਬਹੁਤ ਹੀ ਅਚੰਬਿਤ ਹੋਏ ਅਤੇ ਉਹਨਾਂ ਦੀ ਬੋਲੀ ਸੁਣ ਕੇ ਸਾਨੂੰ ਬਹੁਤ ਹੀ ਵਧੀਆ ਵੀ ਲੱਗਿਆ ਕਿਉਂਕਿ ਉੱਦਾਂ ਦੀ ਬੋਲੀ ਆਪਾਂ ਪਹਿਲੀ ਵਾਰ ਸੁਣੀ ਸੀ ਆਪਾਂ ਹਨੂੰਮਾਨ ਤੋਂ ਗੜ੍ਹ ਅੱਗੇ ਜਿੱਥੇ ਗੋਗਾ ਮਾੜੀ ਗਏ ਸੀ ਜਿੰਨ੍ਹਾਂ ਨੂੰ ਆਪਾਂ ਮੰਨਦੇ ਹਨ ਕੁਲ ਦੇਵਤਾ ਗੁਰੂ ਗੋਗਾ ਜਾਹਰ ਪੀਰ ਜੀ ਉਹ ਇੱਕ ਬਹੁਤ ਹੀ ਵੱਡੇ ਬੀਰ ਪੈਗੰਬਰ ਹੋਏ ਹਨ ਜਿੰਨਾਂ ਨੂੰ ਸਾਰੇ ਸਿੱਖ ਜਾਤੀ ਮੁਸਲਿਮ ਜਾਤੀ ਹਿੰਦੂ ਸਾਰੇ ਮੰਨਦੇ ਹਨ ਜਿਹਦੇ ਪਿੱਛੇ ਵੀ ਇੱਕ ਕਹਾਣੀ ਹੈ ਇਸ ਤਰ੍ਹਾਂ ਮੇਰਾ ਕੁਝ ਉੱਥੇ ਇੱਦਾਂ ਦਾ ਹਿਸਾਬ ਕਿਤਾਬ ਰਿਹਾ ਧੰਨਵਾਦ